ਯੋਗਾ ਦੇ ਵਿੱਚ ਆਪਾਂ ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕਰ ਸਕਦੇ ਹਾਂ ਰੋਜ਼ਾ ਯੋਗਾ ਰੋਜ਼ਾਨਾ ਕਰਨ ਦੇ ਨਾਲ ਸਾਡਾ ਸਰੀਰ ਤੰਦਰੁਸਤ ਹੋ ਜਾਂਦਾ ਹੈ ਸਾਨੂੰ ਪਿੱਠ ਦੀ ਬਿਮਾਰੀ ਹੋਵੇ ਕੋਈ ਵੀ ਕਿਤੇ ਵੀ ਦਰਦ ਹੁੰਦੀ ਹੋਵੇ ਮੋਢੇ ਦਰਦ ਹੁੰਦੇ ਹੋਣ ਸਰਵਾਈਕਲ ਹੋਵੇ ਗਰਦਨ ਦਰਦ ਹੋ ਰਹੀ ਹੈ ਗੋਡੇ ਦਰਦ ਹੁੰਦੇ ਪਏ ਆ ਕੁਛ ਵੀ ਜਦੋਂ ਵੀ ਹੁੰਦਾ ਹੈ ਜੇ ਆਪਾਂ ਯੋਗਾ ਕਰਦੇ ਹਾਂ ਤਾਂ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ ਸਾਡਾ ਮਾਇੰਡ ਸਾਡਾ ਦਿਮਾਗ ਬਿਲਕੁਲ ਫਰੈਸ਼ ਹੋ ਜਾਂਦਾ ਹੈ ਯੋਗਾ ਕਰਨ ਦੇ ਨਾਲ ਅਤੇ ਜਿਸ ਨਾਲ ਲੋਕਾਂ ਦੇ ਵਿੱਚ ਮਨਮੋਹਕ ਅਤੇ ਅਟੈਚਮੈਂਟ ਵੱਧਦੀ ਹੈ ਜਦੋਂ ਸਾਡੇ ਦਿਮਾਗ ਸ਼ਾਂਤ ਰਹੇਗਾ ਉਦੋਂ ਅਸੀਂ ਲੋਕਾਂ ਵੱਲ ਅਕਰਸ਼ਕ ਵੀ ਜ਼ਿਆਦਾ ਹੋਵਾਂਗੇ ਸਾਡਾ ਇਮੋਸ਼ਨਲ ਅਸੀਂ ਇਮੋਸ਼ਨਲ ਵੀ ਅਵੇਲੇਬਲ ਹੋਵਾਂਗੇ ਲੋਕਾਂ ਲਈ ਕੀ ਹਾਂਜੀ ਜੀ ਸਾਨੂੰ ਪਤਾ ਸਾਨੂੰ ਪਤਾ ਹੈ ਤੁਹਾਡਾ ਦੁੱਖ ਤੁਹਾਨੂੰ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਹੈ ਜੇ ਤਾਂ ਸਾਡਾ ਇਹ ਫਿਰ ਸਾਡੀ ਇੱਕ ਦਿਨ ਚਰਿਆ ਹੀ ਐਦਾਂ ਦੀ ਹੋ ਜਾਂਦੀ ਹੈ ਜਿਹਦੇ ਨਾਲ ਕਿ ਅਸੀਂ ਲੋਕਾਂ ਦੇ ਨਾਲ ਅਟੈਚ ਹੋ ਜਾਂਦੇ ਹੈਗੇ ਹਾਂ ਅਤੇ ਸਾਡੀ ਮਨਮੋਹਕਤਾ ਲੋਕਾਂ ਵੱਧ ਜਾਂਦੀ ਹੈ ਆਪਣੇ ਜੀਵਨ ਵਿੱਚ ਯੋਗਾ ਨੂੰ ਇੱਕ ਮਹੱਤਵਪੂਰਨ ਪੂਰਨ ਦੇਣਾ ਚਾਹੀਦਾ ਹੈ ਯੋਗਦਾਨ ਯੋਗਾ ਦਾ ਸਾਡੇ ਸਰੀਰ ਨੂੰ ਸਹੀ ਕਰਨ ਵਿੱਚ ਅੰਦਰੋਂ ਸਾਡਾ ਸਰੀਰ ਯੋਗਾ ਕਰਨ ਨਾਲ ਬਿਲਕੁਲ ਸੈੱਟ ਸਹੀ ਹੋ ਜਾਂਦਾ ਹੈ ਜੇ ਤਾਂ ਸਾਡਾ ਸਰੀਰ ਜੇ ਤਾਂ ਅਸੀਂ ਚਾਹੁੰਦੇ ਹਾਂ ਸਾਡਾ ਸਰੀਰ ਯੋਗਾਂ ਨਾਲ ਸੈੱਟ ਹੋ ਜਾਵੇ ਜੇ ਤਾਂ ਅਸੀਂ ਚਾਹੁੰਦੇ ਹਾਂ ਸਾਡਾ ਸਰੀਰ ਸਹੀ ਰਹੇ ਤਾਂ ਸਾਨੂੰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਧੰਨਵਾਦ